ਹਾਂਜੀ ਯੋਗਾ ਦੇਖੋ ਹਰ ਇੱਕ ਨੂੰ ਕਰਨਾ ਚਾਹੀਦਾ ਆਪਣੇ ਸਰੀਰ ਨੂੰ ਤੰਦਰੁਸਤ ਅਤੇ ਦਿਮਾਗ ਨੂੰ ਚੁਸਤ ਰੱਖਣ ਵਾਸਤੇ ਸਾਡੀ ਯੋਗਾ ਕਰਨਾ ਬਹੁਤ ਜ਼ਰੂਰੀ ਆ ਯੋਗਾ ਕਰਨ ਦੇ ਬਹੁਤ ਫ਼ਾਇਦੇ ਨੇ ਇੱਕ ਤਾਂ ਜਿਹੜਾ ਸਰੀਰ ਸਾਰਾ ਦਿਨ ਐਨ ਚੁਸਤ ਰਹਿੰਦਾ ਵਾ ਰੋਗ ਨਹੀਂ ਲਾਗੇ ਆਉਂਦੇ ਬੰਦਾ ਵਧੀਆ ਰਹਿੰਦਾ ਮੈਂ ਸ ਯੋਗਾ ਕਰਦਾਂ ਹਾਂ ਸਵੇਰੇ ਕਰਦਾਂ ਮੈਂ ਯੋਗਾ ਕਰਨ ਘੱਟੋ ਘੱਟ ਮੈਂ ਪੰਤਾਲੀ ਮਿੰਟ ਸਵੇਰੇ ਯੋਗਾ ਕਰਦਾਂ ਅਤੇ ਸਾਡੇ ਲਾਗੇ ਇੱਥੇ ਇੱਕ ਪਾਰਕ ਹੈ ਉੱਥੇ ਚਲੇ ਜਾਈਦਾ ਇੱਕ ਤਾਂ ਸਵੇਰੇ ਤਾਜ਼ੀ ਹਵਾ ਹੁੰਦੀ ਆ ਠੀਕ ਆ ਜੀ ਕੋਈ ਉੱਥੇ ਪ੍ਰਦੂਸ਼ਣ ਨਹੀਂ ਹੁੰਦਾ ਕਿਸੇ ਤਰ੍ਹਾਂ ਦਾ ਸਵੇਰੇ ਸਵੇਰੇ ਸਾਫ਼ ਮੌਸਮ ਹੁੰਦਾ ਠੰਡੇ ਠੰਡੇ ਉੱਥੇ ਯੋਗਾ ਕਰਨ ਜਾਂਦੇ ਹਾਂ ਜੀ ਕਾਫ਼ੀ ਲੋਕ ਲੱਗੇ ਹੁੰਦੇ ਆ ਯੋਗਾ ਕਰਨੀ ਚਾਹੀਦੀ ਆ ਜੇ ਚੱਲਣਾ ਫਿਰਨਾ ਤਾਂ ਸਭ ਕੁਛ ਆ ਜੇ ਤੁਹਾਡਾ ਸਰੀਰ ਤੰਦਰੁਸਤ ਆ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਫਿਟ ਹੋ ਉਹਦਾ ਇੱਕੋ ਹੀ ਕਾਰਨ ਆ ਯੋਗਾ ਜੇ ਤੁਸੀਂ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਮੇਸ਼ਾ ਆਪਣੀ ਦੇਖੋ ਆਪਣੇ ਸਰੀਰ ਵਾਸਤੇ ਬੰਦਾ ਚਾਲੀ ਪੰਤਾਲੀ ਮਿੰਟ ਕੋਈ ਵੱਡੀ ਗੱਲ ਨਹੀਂ ਹੈਗੀ ਚਾਲੀ ਪੰਤਾਲੀ ਮਿੰਟ ਤਾਂ ਕੱਢ ਹੀ ਸਕਦਾ ਬੰਦਾ ਇੱਕ ਟਾਈਮ 'ਚ ਖਾਣਾ ਸਮੇਂ ਸਿਰ ਖਾਣਾ ਖਾ ਕੇ ਜਲਦੀ ਸੋ ਜਾਓ ਰਾਤ ਨੂੰ ਸਵੇਰੇ ਜਲਦੀ ਉੱਠੋ ਕਰਨਾ ਚਾਹੀਦਾ ਹਰ ਇੱਕ ਨੂੰ ਯੋਗਾ ਯੋਗਾ ਬੈਸਟ ਆ ਸਾਰੇ ਸ ਵਾ ਸਾਰਿਆਂ ਵਾਸਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰ ਇੱਕ ਨੂੰ ਯੋਗਾ ਕਰਨਾ ਚਾਹੀਦਾ